ਸਾਡੇ ਪਿੰਡ ਵਿੱਚ ਇੱਕ ਭਜਨ ਮੰਡਲੀ ਹੈ ਜੋ ਕਿ ਸ਼ਿਵ ਭਜਨ ਮੰਡਲੀ ਦੇ ਨਾਂ ਵਜੋਂ ਜਾਣੀ ਜਾਂਦੀ ਹੈ ਇਹ ਵੈਸੇ ਤਾਂ ਆਮ ਤੌਰ 'ਤੇ ਸ਼ਿਵ ਜੀ ਮੰਦਰ ਵਿੱਚ ਹੀ ਇਕੱਠੇ ਹੁੰਦੇ ਹਨ ਅਤੇ ਉੱਥੇ ਹਰ ਰੋਜ਼ ਭਜਨ ਕੀਰਤਨ ਕਰਦੇ ਹਨ ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਇਹਨਾਂ ਦੇ ਭਜਨ ਕੀਰਤਨ ਦਾ ਆਨੰਦ ਲੈਣ ਆਉਂਦੇ ਹਨ ਇਹ ਬਹੁਤ ਵਧੀਆ ਢੰਗ ਨਾਲ ਭਜਨ ਕੀਰਤਨ ਕਰਦੇ ਹਨ ਇਹ ਸੰਗੀਤ ਲਈ ਕਾਫੀ ਯੰਤਰਾਂ ਦਾ ਪ੍ਰਯੋਗ ਕਰਦੇ ਹਾਂ ਜਿਵੇਂ ਕਿ ਢੋਲਕੀ ਛਣਕਣਾ ਚਿਮਟਾ ਅਤੇ ਇਸ ਤੋਂ ਇਲਾਵਾ ਵੀ ਹੋਰ ਯੰਤਰ ਵਰਤੇ ਜਾਂਦੇ ਹਨ ਇਹ ਸਿਰਫ ਮੰਦਰ ਵਿੱਚ ਹੀ ਨਹੀਂ ਸਗੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੀ ਭਜਨ ਕੀਰਤਨ ਕਰਦੇ ਹਨ ਅਤੇ ਬਹੁਤ ਹੀ ਆਨੰਦਮਈ ਵਾਤਾਵਰਨ ਬਣਾਉਂਦੇ ਹਨ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਭਜਨ ਗਾਉਂਦੇ ਹਨ ਅਤੇ ਲੋਕਾਂ ਦਾ ਮਨ ਮੋਹ ਲੈਂਦੇ ਹਨ ਇਸ ਤੋਂ ਇਲਾਵਾ ਇਹ ਹੋਰ ਵੀ ਕਈ ਪ੍ਰੋਗਰਾਮਾਂ ਵਿੱਚ ਭਜਨ ਗਾਉਣ ਲਈ ਜਾਂਦੇ ਹਨ ਪਰ ਮੁੱਖ ਤੌਰ 'ਤੇ ਇਹ ਮੰਦਰ ਵਿੱਚ ਹੀ ਹਰ ਰੋਜ਼ ਭਜਨ ਕਰਦੇ ਹਨ